ਸਾਡੇ ਖੇਤਰ ਵਿੱਚ ਪ੍ਰਮੁੱਖ ਤੌਰ 'ਤੇ ਟੇ ਟੇਬਲ ਟੈਨਿਸ ਕਬੱਡੀ ਫੁੱਟਬਾਲ ਕ੍ਰਿਕਟ ਹੋਕੀ ਆਦਿਕ ਖੇਡਾਂ ਖੇਡੀਆਂ ਜਾਂਦੀਆਂ ਨੇ ਅਤੇ ਇਹਨਾਂ ਖੇਡਾਂ ਨੂੰ ਖੇਡਣ ਦੇ ਸਮਰੱਥ ਜਿਹੜੇ ਖਿਡਾਰੀ ਨੇ ਓਹਨਾਂ ਦੀ ਮਦਦ ਕਰਨ ਦੇ ਲਈ ਸਭ ਤੋਂ ਪਹਿਲਾਂ ਓਹਨਾਂ ਦੇ ਲਈ ਜੋ ਸਾਫ ਸੁਥਰਾ ਮੈਦਾਨ ਹੈ ਜਿਹਦੇ ਵਿੱਚ ਰੌਸ਼ਨੀ ਦਾ ਪੂਰਾ ਪੂਰਾ ਪ੍ਰਬੰਧ ਹੋਏ ਰਾਤ ਨੂੰ ਖੇਡਣ ਦੇ ਲਈ ਓਹ ਖੇਡਾਂ ਜਿਹੜੇ ਮੈਦਾਨ ਨੇ ਓਹ ਸਾਫ ਸੁਥਰੇ ਬਣਾਏ ਜਾਂਦੇ ਨੇ ਓਸ ਤੋਂ ਬਿਨਾਂ ਹਰ ਖੇਡ ਦੇ ਖਿਡਾਰੀਆਂ ਦੇ ਜਿਹੜੀਆਂ ਵੱਖਰੀਆਂ ਵੱਖਰੀਆਂ ਲੋੜਾਂ ਹੁੰਦੀਆਂ ਨੇ ਜਿਵੇਂ ਕਬੱਡੀ ਦੇ ਖਿਡਾਰੀਆਂ ਲਈ ਖਾਸ ਤੌਰ 'ਤੇ ਖੁਰਾਕ ਅਤੇ ਓਹਨਾਂ ਦਾ ਇੱਕ ਵੱਖਰਾ ਆਪਣਾ ਮੈਦਾਨ ਹੁੰਦਾ ਹੈ ਕ੍ਰਿਕਟ ਦੇ ਖਿਡਾਰੀਆਂ ਦੇ ਲਈ ਬੈਟ ਅਤੇ ਗੇਂਦ ਓਹਨਾਂ ਦੇ ਲਈ ਡਰੈੱਸ ਹਾਕੀ ਦੇ ਖਿਡਾਰੀਆਂ ਲਈ ਹਾਕੀ ਓਹਨਾਂ ਦੀ ਆਪਣੀ ਗੇਂਦ ਵੱਖਰੀ ਅਤੇ ਓਹਨਾਂ ਦੇ ਜਿਹੜੇ ਪੋਲ ਵੱਖਰੇ ਨੇ ਓਹ ਸਾਰੇ ਦਾ ਸਾਰਾ ਉਹਨਾਂ ਨੂੰ ਚੀਜ਼ਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਇਸ ਤੋਂ ਬਿਨਾਂ ਓਹਨਾਂ ਦੇ ਵਿੱਚ ਖਿਡਾਰੀਆਂ ਵਿੱਚ ਖੇਡਾਂ ਦਾ ਉਤਸ਼ਾਹ ਬਣਾਈ ਰੱਖਣ ਦੇ ਲਈ ਉਹਨਾਂ ਵੱਖਰੇ ਵੱਖਰੇ ਖਿਡਾਰੀਆਂ ਦੇ ਵੱਖਰੇ ਵੱਖਰੇ ਪਿੰਡਾਂ ਦੇ ਹਿਸਾਬ ਨਾਲ ਉਹਨਾਂ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਜਾਂਦੇ ਨੇ